ਹਾਂਜੀ ਮੇਰੇ ਨਾਲ ਇੱਕ ਹੁਣੀ ਹੁਣੀ ਮਹੀਨਾ ਕੁ ਪਹਿਲਾਂ ਘਟਨਾ ਵਾਪਰੀ ਹੈ ਅਣਕਿਆਸੀ ਅਤੇ ਮੇਰੇ ਪੈਰਾਂ ਦੇ ਵਿੱਚ ਬਹੁਤ ਬੜਾ ਸੱਪ ਆ ਗਿਆ ਸੀ ਅਤੇ ਮੈਨੂੰ ਬਹੁਤ ਡਰ ਲੱਗਿਆ ਉਸ ਤੋਂ